ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਠਾਨਕੋਟ ਤੋਂ ਹਰਜੀਤ ਕੌਰ ਬੋਲ ਰਹੀ ਹਾਂ ਜਿਵੇਂ ਕਿ ਸਾਡੇ ਖੇਤਰ ਵਿੱਚ ਕਾਫੀ ਧਾਰਮਿਕ ਪਰੰਪਰਾਵਾਂ ਮਸ਼ਹੂਰ ਹਨ ਜਿਵੇਂ ਕਿ ਸਾਡੇ ਰੀਤੀ ਰਿਵਾਜ਼ ਹਨ ਜਿਵੇਂ ਸਾਡੇ ਵਿਆਹ ਹੁਣ ਸ਼ਾਦੀ ਹੁੰਦੇ ਹਨ ਜਿਵੇਂ ਲੜਕੀ ਦੇ ਵਿਆਹ ਵਿੱਚ ਸੁਹਾਗ ਬੋਲੇ ਜਾਂਦੇ ਹਨ ਅਤੇ ਲੜਕੇ ਦੇ ਵਿਆਹ 'ਚ ਘੋੜੀਆਂ ਬੋਲੀਆਂ ਜਾਂਦੀਆਂ ਹਨ ਅਤੇ ਇਹਨਾਂ ਦੇ ਨਾਲ ਹੀ ਸਾਡੇ ਰੀਤੀ ਰਿਵਾਜ਼ ਸ਼ੁਰੂ ਹੁੰਦੇ ਹਨ ਜਦੋਂ ਕਿਸੇ ਦੇ ਘਰ ਲੜਕਾ ਹੁੰਦਾ ਹੈ ਜਾਂ ਛੋਟਾ ਬੱਚਾ ਹੈ ਹੁੰਦਾ ਹੈ ਅਤੇ ਉਸਨੂੰ ਗੁਰਦੁਆਰੇ ਮੱਥਾ ਟਿਕਾਉਣ ਖੜ੍ਹਦੇ ਹਨ ਅਤੇ ਗੁਰਦੁਆਰੇ ਮੱਥੇ ਟਿਕਾਉਣ ਤੋਂ ਬਾਅਦ ਉਹਦੀ ਉਹਦੀ ਨਾਮ ਰਸਮ ਨਾਮ ਦੀ ਰਸਮ ਕੀਤੀ ਜਾਂਦੀ ਹੈ ਜਿਵੇਂ ਕਿ ਸਾਡੇ ਵਿੱਚ ਇਹ ਵੀ ਪਰੰਪਰਾ ਮਸ਼ਹੂਰ ਹੈ ਕਿ ਜਿਵੇਂ ਕਿਸੇ ਦੇ ਵਿਆਹ ਸ਼ਾਦੀ ਤੋਂ ਬਾਅਦ ਉਹਨਾਂ ਦੇ ਜਠੇਰੇ ਵਗੈਰਾ ਉਹਨਾਂ ਦੀ ਵੀ ਪੂਜਾ ਕੀਤੀ ਜਾਂਦੀ ਹੈ ਜਿਵੇਂ ਕਿ ਅਸੀਂ ਸਾਡੇ ਤੀਰਥ ਅਸਥਾਨ ਹੈ ਜਿਵੇਂ ਹੇਮਕੁੰਟ ਸਾਹਿਬ ਅਸੀਂ ਯਾਤਰਾ 'ਤੇ ਜਾਂਦੇ ਹਨ ਅਤੇ ਵੈਸ਼ਨੋ ਦੇਵੀ ਜਾਂਦੇ ਹਾਂ ਕਾਫੀ ਮਤਲਬ ਸਾਡੇ ਤੀਰਥ ਅਸਥਾਨ ਹੈ ਜਿੱਥੇ ਅਸੀਂ ਜਾਂਦੇ ਹਾਂ ਜਿਵੇਂ ਕਿ ਯਾਤਰਾ ਦਰਬਾਰ ਸਾਹਿਬ ਹੇਮਕੁੰਟ ਸਾਹਿਬ ਵੈਸ਼ਨੋ ਦੇਵੀ ਜਿਵੇਂ ਨਾਗਨੀ ਮਾਤਾ ਇਸ ਤਰ੍ਹਾਂ ਦੇ ਸਾਡੇ ਕਾਫੀ ਧਾਰਮਿਕ ਅਸਥਾਨ ਹਨ ਜਿੱਥੇ ਅਸੀਂ ਆਪਣਾ ਯਾਤਰਾ 'ਤੇ ਜਾਂਦੇ ਹਨ ਅਤੇ ਉਹਨਾਂ ਦੀ ਯਾਤਰਾ ਦਾ ਆਨੰਦ ਮਾਣਦੇ ਹਾਂ